ਸਤਿ ਸ਼੍ਰੀ ਅਕਾਲ ਅੱਜ ਮੈਂ ਆਪਣੇ ਪਿੰਡ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਪਿੰਡਾਂ ਦੀ ਤਾਂ ਗੱਲ ਹੀ ਹੋਰ ਹੈ ਜੋ ਮਜ਼ਾ ਪਿੰਡਾਂ ਵਿੱਚ ਹੈ ਉਹ ਕਿਤੇ ਹੋਰ ਨਹੀਂ ਪਿੰਡ ਦੀ ਤੁਲਨਾ ਸ਼ਹਿਰ ਨਾਲ ਤਾਂ ਕੀਤੀ ਨਹੀਂ ਜਾ ਸਕਦੀ ਜਿੰਨਾ ਗੰਦ ਸ਼ਹਿਰ ਵਿੱਚ ਹੈ ਉਸ ਤੋਂ ਕਈ ਗੁਣਾ ਘੱਟ ਪਿੰਡਾਂ ਵਿੱਚ ਹੈ ਜੋ ਮਜ਼ਾ ਪਿੰਡ ਵਿੱਚ ਹੈ ਉਹ ਸ਼ਹਿਰ ਵਿੱਚ ਨਹੀਂ ਆ ਸਕਦਾ ਭਾਵੇਂ ਸ਼ਹਿਰ ਵਿੱਚ ਕਿੰਨੀ ਹੀ ਤਰੱਕੀ ਨਾ ਹੋ ਜਾਵੇ ਕਿੰਨਾ ਹੀ ਪੈਸਾ ਨਾ ਹੋ ਜਾਵੇ ਪਰ ਪਿੰਡਾਂ ਦਾ ਮਜ਼ਾ ਅਲੱਗ ਹੀ ਹੈ ਪਿੰਡਾਂ ਵਿੱਚ ਹਰੇ ਭਰੇ ਪੇੜ ਜੋ ਸਾਨੂੰ ਸ਼ੁੱਧ ਹਵਾ ਦਿੰਦੇ ਨੇ ਫਿਰ ਸਾਫ ਸੁਥਰੀਆਂ ਗਲੀਆਂ ਪਿੰਡਾਂ ਵਿੱਚ ਰੋਣਕ ਨਿਆਣਿਆਂ ਦੀ ਚਹਿਲ ਪਹਿਲ ਹੋਰ ਵੀ ਕਈ ਐਸੀ ਚੀਜ਼ਾਂ ਹਨ ਜੋ ਸਾਨੂੰ ਸੁੱਖ ਪ੍ਰਾਪਤ ਕਰਦੀਆਂ ਹਨ ਪਿੰਡ ਦੀ ਹਵਾ ਬਹੁਤ ਹੀ ਸ਼ੁੱਧ ਹੁੰਦੀ ਹੈ ਲੇਕਿਨ ਜੇ ਅਸੀਂ ਗੱਲ ਕਰੀਏ ਸ਼ਹਿਰ ਨਾਲ ਸ਼ਹਿਰ ਦੀ ਹਵਾ ਤਾਂ ਪ੍ਰਦੂਸ਼ਣ ਨਾਲ ਭਰੀ ਹੁੰਦੀ ਹੈ ਕਿਉਂਕਿ ਸ਼ਹਿਰ ਵਿੱਚ ਬਹੁਤ ਸਾਰੀਆਂ ਗੱਡੀਆਂ ਮੋਟਰਾਂ ਚਲਦੀਆਂ ਹਨ ਜਿਸ ਨਾਲ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ ਅਤੇ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ ਅਤੇ ਸ਼ਹਿਰਾਂ ਵਿੱਚ ਕਈ ਫੈਕਟਰੀਆਂ ਖੁੱਲ੍ਹੀਆਂ ਹਨ ਜਿਸ ਨਾਲ ਹ ਹਵਾ ਉਹ ਜਿਸ ਜੋ ਕਿ ਹਵਾ ਨੂੰ ਗੰਦੀਆਂ ਕਰਦੇ ਹਨ ਪਰ ਪਿੰਡ ਵਿੱਚ ਐਸਾ ਕੁਝ ਨਹੀਂ ਹੈ ਪਿੰਡ ਵਿੱਚ ਬਹੁਤ ਹੀ ਸਕੂਨ ਹੈ ਅਤੇ ਆਨੰਦ ਆਉਂਦਾ ਹੈ ਪਿੰਡਾਂ ਵਿੱਚ ਲੋਕ ਲੋਕਾਂ ਨੇ ਆਪਣੇ ਲੋਕਾਂ ਕੋਲ ਗੱਡੀਆਂ ਨਹੀਂ ਹੁੰਦੀਆਂ ਪਰ ਓ ਉਹਨਾਂ ਕੋਲ ਆਪ ਬਣਾਏ ਸਾਈਕਲ ਹੁੰਦੇ ਨੇ ਜਾਂ ਫਿਰ ਰੇਹੜੇ ਹੁੰਦੇ ਹਨ ਅਤੇ ਹੋਰ ਵੀ ਬਹੁਤ ਕੁਝ ਹੁੰਦੇ ਹਨ ਜਿਸ ਦੇ ਰਾਹੀਂ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਹਨ ਇਸਦਾ ਮਜ਼ਾ ਇਹ ਹੈ ਕਿ ਉੱਥੇ ਕੋਈ ਪ੍ਰਦੂਸ਼ਣ ਨਾਂ ਦੀ ਚੀਜ਼ ਨਹੀਂ ਅਤੇ ਪਿੰਡਾਂ ਵਿੱਚ ਸਫਾਈ ਸਫਾਈ ਵੀ ਬਹੁਤ ਹੁੰਦੀ ਹੈ ਹੁਣ ਮੈਂ ਗੱਲ ਕਰਨਾ ਚਾਹੁੰਦੀ ਹਾਂ ਸਾਡੇ ਪਿੰਡ ਵਿੱਚ ਪਾਣੀ ਪਿੰਡ ਵਿੱਚ ਪਾਣੀ ਦੇ ਵੱਖ ਵੱਖ ਸਰੋਤ ਪਿੰਡਾਂ ਵਿੱਚ ਮੇਰੇ ਪਿੰਡ ਵਿੱਚ ਪਾਣੀ ਦੇ ਬਹੁਤ ਸਾਰੇ ਸਰੋਤ ਹਨ ਜਿਵੇਂ ਕਿ ਅਸੀਂ ਸਾਡੇ ਪਿੰਡ ਵਿੱਚ ਇੱਕ ਨਹਿਰ ਹੈ ਜੋ ਕਿ ਬਹੁਤ ਹੀ ਡੂੰਘੀ ਨਹਿਰ ਹੈ ਅਤੇ ਉਸ ਦਾ ਪਾਣੀ ਬਹੁਤ ਹੀ ਸਾਫ ਹਨ ਲੋਕ ਪਹਿਲਾਂ ਜਦੋਂ ਪਹਿਲਾਂ ਜਦੋਂ ਟੂਟੀਆਂ ਨਹੀਂ ਲੱਗੀਆਂ ਹੋਈਆਂ ਸਨ ਤਾਂ ਲੋਕ ਕੀ ਕਰਦੇ ਸਨ ਕਿ ਨਹਿਰ 'ਚ ਜਾ ਕੇ ਨਹਿਰੇ ਨਹਿਰ ਦੇ ਵਿੱਚ ਜਾ ਕੇ ਆਪਣੇ ਪਾ ਘਰ ਵਾਸਤੇ ਪਾਣੀ ਭਰ ਲਿਆਉਂਦੇ ਸਨ ਅਤੇ ਕੱਪੜੇ ਅਤੇ ਨਹਾ ਵੀ ਉੱਥੇ ਹੀ ਲੈਂਦੇ ਸਨ ਪਰ ਉਹ ਪਾਣੀ ਨੂੰ ਗੰਦਾ ਨਹੀਂ ਹੋਣ ਦਿੰਦੇ ਇਹ ਤਾਂ ਹੋ ਗਿਆ ਨਹਿਰ ਇਸ ਦੇ ਰਾਹੀਂ ਵੀ ਨਹਿਰ ਦਾ ਪਾਣੀ ਵੀ ਬਹੁਤ ਕੰਮ ਆ ਗਿਆ ਆਉਂਦਾ ਸੀ ਦੂਜਾ ਆ ਗਿਆ ਖੂਹ ਲੋਕਾਂ ਨੇ ਆਪਣੇ ਘਰਾਂ ਵਿੱਚ ਖੂਹ ਕਢਵਾਏ ਸਨ ਖੂਹ ਕਢਵਾਏ ਹੁੰਦੇ ਸਨ ਇਸ ਵੇਲੇ ਲੋਕ ਖੂਹ ਦੇ ਰਾਹੀਂ ਲੋਕ ਪਾਣੀ ਲੋਕ ਪ ਆਪਣੇ ਘਰਾਂ ਵਿੱਚ ਪਾਣੀ ਭਰਦੇ ਸਨ ਅਤੇ ਉਹਨਾਂ ਨੂੰ ਕੋਈ ਪਾਣੀ ਦੀ ਕੋਈ ਤੰਗੀ ਨਹੀਂ ਆਉਂਦੀ ਸੀ ਹੁਣ ਅਸੀਂ ਇੱਕ ਹੋਰ ਗੱਲ ਕਰਨਗੇ ਟੂਟੀਆਂ ਦੀ ਹੁਣ ਤਾਂ ਘਰ ਘਰ ਵਿੱਚ ਟੂਟੀਆਂ ਲੱਗੀਆਂ ਹੋਈਆਂ ਹਨ ਜਿਸ ਜੋ ਜੋ ਕਿ ਬਹੁਤ ਹੀ ਮਜ਼ੇ ਦੇ ਰਹੇ ਨੇ ਟੂਟੀਆਂ ਦੇ ਰਾਹੀਂ ਸਾਨੂੰ ਪਾਣੀ ਮਿਲਦਾ ਹੈ ਪੀਣ ਵਾਲਾ ਉਸ ਲਈ ਉਸਦੇ ਘਰ ਟੂਟੀਆਂ ਦੇ ਲੱਗਣ ਨਾਲ ਸਾਡਾ ਕਈ ਕਈ ਕੰਮ ਸੌਖੇ ਹੋ ਗਏ ਹਨ ਅਤੇ ਸਾਨੂੰ ਦੂਰ ਨਹੀਂ ਜਾਣਾ ਪੈਂਦਾ ਇਸਦਾ ਪਾਣੀ ਵੀ ਸਾਫ ਸੁਥਰਾ ਹੁੰਦਾ ਹੈ ਅਤੇ ਸ਼ੁ ਪੀਣ ਲਈ ਵੀ ਸਹੀ ਹੈ ਇਹ ਪਾਣੀ ਕੱਪੜੇ ਧੋਣ ਨਹਾਉਣ ਅਤੇ ਪੀਣ ਸਾਰਿਆਂ ਦੇ ਕੰਮ ਆਉਂਦਾ ਹੈ ਇੱਕ ਘਰਾਂ ਘਰਾਂ ਵਿੱਚ ਨਲਕੇ ਵੀ ਲੱਗੇ ਹੋਏ ਹਨ ਜਿਸ ਨਾਲ ਇੱਕ ਤਾਂ ਸਾਨੂੰ ਪਾਣੀ ਮਿਲ ਜਾਂਦਾ ਹੈ ਅਤੇ ਦੂਜਾ ਸਾਡੇ ਉਸਨੂੰ ਗੇੜਨ ਨਾਲ ਸਾਡੇ ਬਾਹਵਾਂ ਦੀ ਐਕਸਰਸਾਈਜ਼ ਹੋ ਜਾਂਦੀ ਹੈ

ਇਹ ਸਾਰਾ ਹੈ ਸਾਨੂੰ ਪਰ ਇਹ ਗ ਟੂਟੀਆਂ ਦਾ ਪਾਣੀ ਪੂਰਾ ਸਾਲ ਨਹੀਂ ਮਿਲਦਾ ਜਦੋਂ ਕਿਤੇ ਨਹਿਰ ਸੁੱਕ ਜਾਂਦੀ ਹੈ ਕਈ ਮੀ ਸਾਲਾਂ ਸਾਲ ਵਿੱਚ ਕਈ ਦੋ ਮਹੀਨੇ ਐਸੇ ਹੁੰਦੇ ਹਨ ਜਦੋਂ ਸਰਕਾਰ ਨਹਿਰ ਬੰਦ ਕਰ ਦਿੰਦੀ ਹੈ ਉਸਦੀ ਸਫਾਈ ਲਈ ਉਦੋਂ ਪਾਣੀ ਦੀ ਤੰਗੀ ਆਉਂਦੀ ਹੈ ਉਸ ਉਸ ਤੰਗੀ ਦੇ ਉਸ ਤੰਗੀ ਕਾਰਨ ਵੋ ਲੋਕ ਬਹੁਤ ਪਰੇਸ਼ਾਨ ਹੁੰਦੇ ਹਨ ਪਰ ਇਸ ਪਰੇਸ਼ਾਨੀ ਨੂੰ ਇਸ ਪਰੇਸ਼ਾਨੀ ਤੋਂ ਨਿਕਲਣ ਲਈ ਸਰਕਾਰ ਨੇ ਘਰ ਘਰ ਵਿੱਚ ਪਾਣੀ ਦੀ ਪੀਣ ਵਾਲੇ ਪਾਣੀਆਂ ਦੀ ਟੂਟੀਆਂ ਲਗਾ ਦਿੱਤੀਆਂ ਗਈਆਂ ਹਨ ਜੋ ਕਿ ਜੋ ਜਿਸ ਤਾਂ ਰਾਹੀਂ ਸਾਡੇ ਘਰਾਂ ਵਿੱਚ ਤਿੰਨ ਟਾਈਮ ਪਾਣੀ ਆ ਰਿਹਾ ਹੈ ਅਤੇ ਲੋਕ ਪਾਣੀ ਦਾ ਆਨੰਦ ਮਾਣ ਰਹੇ ਹਨ ਅਤੇ ਖੁਸ਼ੀਆਂ ਮਨਾ ਰਹੇ ਹਨ ਧੰਨਵਾਦ